ਸਾਡੇ ਸੱਭਿਆਚਾਰ ਵਿੱਚ ਮੁੱਖ ਕਿੱਤਾ ਖੇਤੀਬਾੜੀ ਹੈ ਕਿਉਂਕਿ ਖੇਤੀਬਾੜੀ ਸਾਡੇ ਪੁਰਾਣੇ ਸਮਿਆਂ ਤੋਂ ਚਲਦੀ ਆ ਰਹੀ ਹੈ ਸਾਡੇ ਬਜ਼ੁਰਗ ਹੈ ਉਹ ਵੀ ਖੇਤੀਬਾੜੀ ਕਰਦੇ ਸੀ ਅਤੇ ਅੱਜ ਦੇ ਟਾਈਮ ਵਿੱਚ ਅਸੀਂ ਵੀ ਖੇਤੀਬਾੜੀ ਕਰ ਰਹੇ ਹਾਂ ਪਰ ਪਹਿਲਾਂ ਵਾਲੀ ਖੇਤੀਬਾੜੀ ਦੇ ਨਾਲੋਂ ਅੱਜ ਦੀ ਖੇਤੀਬਾੜੀ ਵਿੱਚ ਬਹੁਤ ਫ਼ਰਕ ਹੈ ਕਿਉਂਕਿ ਪਹਿਲਾਂ ਜੋ ਸੀ ਰੇਹਾਂ ਸਪਰੇਆਂ ਅਤੇ ਖਾਦਾਂ ਬਹੁਤ ਵਧੀਆ ਆਉਂਦੇ ਸੀ ਆਉਂਦੀਆਂ ਸੀ ਅਤੇ ਖ਼ਰਚਾ ਇੰਨਾ ਜ਼ਿਆਦਾ ਨਹੀਂ ਹੁੰਦਾ ਸੀ ਅਤੇ ਕਮਾਈ ਵੀ ਕਾਫੀ ਹੋ ਜਾਂਦੀ ਸੀ ਪਰ ਅੱਜ ਦੇ ਟਾਈਮ ਵਿੱਚ ਕਿਸਾਨ ਨਾ ਸਮਝ ਲਓ ਵੀ ਫੇਲ ਹੀ ਹੈ ਕਿਉਂਕਿ ਅੱਜ ਕੱਲ ਰੇਹਾਂ ਸਪਰੇਆਂ ਵਿੱਚ ਵੀ ਬਹੁਤ ਮਿਲਾਵਟਾਂ ਆ ਰਹੀਆਂ ਅਤੇ ਫਸਲਾਂ ਦੇ ਮੁੱਲ ਵੀ ਪ੍ਰੋਪਰ ਨਹੀਂ ਮਿਲ ਪਾਉਂਦੇ ਕਿਉਂਕਿ ਪਹਿਲਾਂ ਤਾਂ ਕਿਸਾਨਾਂ ਨੂੰ ਰੇਟ ਸਹੀ ਮਿਲ ਜਾਂਦੇ ਸੀ ਅਤੇ ਕਮਾਈ ਚੰਗੀ ਹੋ ਜਾਂਦੀ ਸੀ ਬਾਕੀ ਪਹਿਲਾਂ ਸਭ ਮਿਹਨਤ ਕਰਦੇ ਸੀ ਅੱਜ ਕੱਲ ਹਰ ਕੋਈ ਇਸ ਤੋਂ ਖੇਤੀ ਤੋਂ ਡਰਦੇ ਹਨ ਅਤੇ ਨਹੀਂ ਕਰਦੇ ਧੰਨਵਾਦ ਜੀ